ਇੱਕ ਵਾਰ ਦੀ ਗੱਲ ਹੈ ਜਦੋਂ ਮੈਂ ਨੌਵੀਂ ਜਮਾਤ ਵਿੱਚ ਪੜ੍ਹਦਾ ਸੀ ਮੈਂ ਹਰ ਰੋਜ਼ ਸਕੂਲ ਜਾਣ ਨੂੰ ਰੋਂਦਾ ਸੀ ਪਰ ਮੇਰੇ ਘਰਦੇ ਮੈਨੂੰ ਜਬਰਦਸਤੀ ਭੇਜ ਦਿੰਦੇ ਸੀ ਇੱਕ ਦਿਨ ਇੱਦਾਂ ਹੀ ਮੀਂਹ ਪੈ ਰਿਹਾ ਸੀ ਪਰ ਮੈਂ ਮੇਰਾ ਜਾਣ ਦਾ ਬਿਲਕੁਲ ਮਨ ਨਹੀਂ ਸੀ ਕਰ ਰਿਹਾ ਅਤੇ ਮੇਰੇ ਘਰਦਿਆਂ ਨੇ ਮੈਨੂੰ ਜਬਰਦਸਤੀ ਸਕੂਲ ਜਾਣ ਲਈ ਤਿਆਰ ਕਰ ਦਿੱਤਾ ਜਦੋਂ ਮੈਂ ਬੱਸ ਸਟੈਂਡ 'ਤੇ ਸਕੂਲ ਦੀ ਬੱਸ ਫੜ੍ਹਨ ਲਈ ਪਹੁੰਚਿਆ ਤਾਂ ਮੇਰੀ ਸਕੂਲ ਦੀ ਬੱਸ ਜਾ ਚੁੱਕੀ ਸੀ ਅਤੇ ਜਿਵੇਂ ਹੀ ਮੈਂ ਘਰ ਵਾਪਿਸ ਆਇਆ ਮੈਨੂੰ ਘਰਦਿਆਂ ਨੇ ਦੁਬਾਰਾ ਜਬਰਦਸਤੀ ਭੇਜ ਦਿੱਤਾ ਕਿ ਹੁਣ ਪੈਦਲ ਹੀ ਜਾ ਤਾਂ ਫਿਰ ਮੈਂ ਸਕੂਲ ਨਹੀਂ ਗਿਆ ਅਤੇ ਬੰਕ ਕਰਕੇ ਬਾਹਰ ਹੀ ਘੁੰਮਣ ਚਲਾ ਗਿਆ ਮੇਰੇ ਬੈਗ ਵਿੱਚ ਫੀਸ ਲਈ ਕੁਛ ਪੈਸੇ ਪਏ ਸੀ ਜਿਨ੍ਹਾਂ ਵਿੱਚੋਂ ਮੈਂ ਥੋੜ੍ਹੇ ਜਿਹੇ ਪੈਸੇ ਖਰਚ ਕੇ ਬਾਹਰ ਘੁੰਮਣ ਲੱਗ ਗਿਆ ਅਤੇ ਖਾਣ ਖਾਣ ਪੀਣ ਲੱਗ ਗਿਆ ਉਸ ਦੇ ਵਿੱਚੋਂ ਹੀ ਮੈਂ ਫਿਲਮ ਦੇਖਣ ਚਲਾ ਗਿਆ ਅਤੇ ਵਾਪਿਸ ਆਉਂਦੇ ਹੋਏ ਕਾਫੀ ਟਾਈਮ ਹੋ ਗਿਆ ਸੀ ਅਤੇ ਜਦੋਂ ਮੈਂ ਘਰ ਨੂੰ ਵਾਪਿਸ ਆ ਰਿਹਾ ਸੀ ਪੈਦਲ ਆਉਂਦੇ ਆਉਂਦੇ ਮੇਰੇ ਮੇਰੇ ਮੇਰੇ ਹੱਥ ਵਿੱਚੋਂ ਕਿਸੇ ਨੇ ਮੋਟਰਸਾਈਕਲ ਵਾਲੇ ਨੇ ਮੇਰਾ ਬੈਗ ਖੋਹ ਲਿਆ ਜਿਸ ਵਿੱਚ ਕਾਫੀ ਪੈਸੇ ਪਏ ਸੀ ਜੋ ਕਿ ਫੀਸ ਜਮ੍ਹਾ ਕਰਨ ਲਈ ਮੈਨੂੰ ਘਰਦਿਆਂ ਨੇ ਦਿੱਤੇ ਸੀ ਅਤੇ ਮੈਂ ਉਸ ਚੋਰ ਦੇ ਮਗਰ ਭੱਜਿਆ ਪਰ ਮੇਰੇ ਤੋਂ ਉਹ ਫੜ ਨਾ ਹੋਇਆ ਅਤੇ ਅੱਗੇ ਜਾ ਕੇ ਇੱਕ ਪੁਲਿਸ ਦਾ ਨਾਕਾ ਵੀ ਸੀ ਜਿਸ ਤੋਂ ਚੋਰ ਵਾਪਿਸ ਮੁੜ ਗਿਆ ਪਰ ਮੈਂ ਉਸ ਨੂੰ ਫਿਰ ਵੀ ਨਾ ਫੜ ਪਾਇਆ ਅਤੇ ਅੱਗੇ ਜਾ ਕੇ ਮੈਂ ਪੁਲਿਸ ਨੂੰ ਸਾਰਾ ਕੁਝ ਚੰਗੀ ਤਰ੍ਹਾਂ ਦੱਸ ਦਿੱਤਾ ਤਾਂ ਫਿਰ ਪੁਲਿਸ ਨੇ ਉਸ ਚੋਰ ਨੂੰ ਫੜ ਲਿਆ ਅਤੇ ਮੇਰੇ ਪੈਸੇ ਮੈਨੂੰ ਵਾਪਿਸ ਕਰ ਦਿੱਤੇ ਪਰ ਪਰ ਪੁਲਿਸ ਨੇ ਮੈਨੂੰ ਘਰ ਵੀ ਛੱਡ ਦਿੱਤਾ ਅਤੇ ਘਰ ਜਾ ਕੇ ਮੇਰੇ ਘਰਦਿਆਂ ਨੂੰ ਸਭ ਕੁਝ ਦੱਸ ਦਿੱਤਾ ਇਸ ਤਰ੍ਹਾਂ ਮੈ ਇਸ ਤਰ੍ਹਾਂ ਮੈਂ ਫੱਸ ਗਿਆ ਸੀ ਪਰ ਪਰੰਤੂ ਜਦੋਂ ਮੇਰੇ ਘਰਦਿਆਂ ਨੂੰ ਪਤਾ ਲੱਗਾ ਕਿ ਮੈਂ ਸਕੂਲ ਨਹੀਂ ਸੀ ਗਿਆ ਤਾਂ ਮੇਰੇ ਘਰਦਿਆਂ ਨੇ ਮੈਨੂੰ ਬਹੁਤ ਗੁੱਸਾ ਕਰਿਆ ਜਿਸ ਗੱਲ ਦਾ ਮੈਨੂੰ ਚਾਰ ਪੰਜ ਦਿਨ ਤੱਕ ਦੁੱਖ ਰਿਹਾ ਅਤੇ ਮੈਨੂੰ ਬਹੁਤ ਪਛਤਾਵਾ ਹੋਇਆ ਪਰੰਤੂ ਮੈਂ ਇਸ ਗੱਲ ਤੋਂ ਇਹ ਸਿੱਖ ਗਿਆ ਕਿ ਅੱਜ ਤੋਂ ਬਾਅਦ ਮੈਂ ਦੁਬਾਰਾ ਕਦੇ ਵੀ ਆਪਣੇ ਘਰਦਿਆਂ ਨੂੰ ਬਿਨਾਂ ਦੱਸੇ ਕਿਤੇ ਨਹੀਂ ਜਾਵਾਂਗਾ ਅਤੇ ਹੁਣ ਮੈਂ ਖੁਸ਼ੀ ਖੁਸ਼ੀ ਹਰ ਰੋਜ਼ ਸਕੂਲ ਜਾਣ ਲੱਗ ਗਿਆ